ਦੇਖੋ ਸਿੱਖਿਆ ਪ੍ਰਾਪਤ ਕਰਨਾ ਬਹੁਤ ਹੀ ਜ਼ਰੂਰੀ ਹੈ ਸਿੱਖਿਅਤ ਹੋਣਾ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰਦਾ ਹੈ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਪੜ੍ਹੇ ਲਿਖੇ ਬੰਦੇ ਨੂੰ ਅਨਪੜ੍ਹ ਜੋ ਲੋਕ ਹੁੰਦੇ ਹਨ ਨਾ ਉਹਨਾਂ ਨੂੰ ਪੜ੍ਹਨਾ ਆਉਂਦਾ ਨਾ ਕੁਛ ਲਿਖਣਾ ਆਉਂਦਾ ਹੈ ਹੁਣ ਜਿੱਦਾਂ ਅਸੀਂ ਇੱਕ ਤੋਂ ਦੂਜੀ ਜਗ੍ਹਾ ਇਕੱਲੇ ਜਾ ਸਕਦੇ ਹਾਂ ਅਨਪੜ੍ਹ ਲੋਕ ਇਕੱਲੇ ਕਿਤੇ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੂੰ ਕੁਛ ਇੱਕ ਤਾਂ ਉਹ ਪੜ੍ਹੇ ਲਿਖੇ ਨਹੀਂ ਹੁੰਦੇ ਅਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਉਲਝਣਾਂ ਦਾ ਸਾਹਮਣਾ ਕਰਨਾ ਪੈਂਦਾ